ਹਾਂਜੀ ਇਹ ਹੁੰਦਾ ਵਾ ਕਿ ਖਾਣਾ ਬਣਾਉਣਾ ਸਿਰਫ ਔਰਤਾਂ ਦਾ ਹੀ ਕੰਮ ਹੁੰਦਾ ਵਾ ਅਤੇ ਇਹ ਆ ਕਿ ਸਾਡੇ ਜਿਹੜਾ ਸਾਡਾ ਰਹਿਣ ਸਹਿਣ ਇਵੇਂ ਦਾ ਹੋਇਆ ਵਾ ਇੱਥੇ ਪਿੰਡਾਂ ਵਿੱਚ ਇਵੇਂ ਦਾ ਹੁੰਦਾ ਵਾ ਕਿ ਜਿਵੇਂ ਜ਼ਿਆਦਾਤਰ ਖਾਣਾ ਔਰਤਾਂ ਹੀ ਬਣਾਉਂਦੀਆਂ ਵਾ ਅਤੇ ਮਰਦ ਦੂਰ ਦੁਰਾਡੇ ਕੰਮਾਂ 'ਤੇ ਜਾਂਦੇ ਆ ਅਤੇ ਉਹ ਨਹੀਂ ਨਾਲ ਬਣਾ ਸਕਦੇ ਸਵੇਰੇ ਟਾਈਮ ਨਾਲ ਨਿਕਲ ਜਾਣਾ ਫਿਰ ਸ਼ਾਮ ਨੂੰ ਲੇਟ ਆਉਣਾ ਅਤੇ ਉਹਦੇ ਕਰਕੇ ਉਹ ਲੇਟ ਹੋ ਜਾਂਦੇ ਆ ਫਿਰ ਔਰਤਾਂ ਹੀ ਖਾਣਾ ਬਣਾਉਂਦੀਆਂ ਹੈ ਪਰ ਜਦੋਂ ਇਹ ਹੁੰਦਾ ਵਾ ਕਿ ਕੋਈ ਘਰ ਵਿੱਚ ਢਿੱਲ ਮੱਠ ਹੋਵੇ ਨਾ ਠੀਕ ਹੋਵੇ ਪਰ ਮਰਦ ਜਿਹੜੇ ਆ ਉਹ ਮਤ ਵੀ ਕਰਵਾਉਂਦੇ ਆ ਕੇ ਜੇ ਕਿਤੇ ਦੂਰ ਚਲੇ ਜਾਂਦੇ ਫਿਰ ਉਹਨਾਂ ਨੂੰ ਖੁਦ ਵੀ ਖਾਣਾ ਬਣਾ ਕੇ ਖਾਣਾ ਪੈਂਦਾ ਵਾ ਅਤੇ ਉਹ ਖੁਦ ਵੀ ਖਾਣਾ ਬਣਾ ਕੇ ਖਾ ਸਕਦੇ ਆ ਅਤੇ ਖੁਦ ਕਰਦੇ ਵੀ ਆ ਜਦੋਂ ਦੂਰ ਕਿਤੇ ਜਾਂਦੇ ਆ ਅਤੇ ਔਰਤਾਂ ਦਾ ਵੀ ਇਹ ਆ ਪੀ ਜੇ ਦੂਰ ਕੰਮ ਕਰਨ ਜਾਂਦੀਆਂ ਵਾ ਤਾਂ ਖੁਦ ਬਣਾਉਂਦੀਆਂ ਵਾ ਅਤੇ ਇਕੱਲੀਆਂ ਖਾਂਦੀਆਂ ਵਾ ਜੇ ਸਾਰੇ ਪਰਿਵਾਰ ਦੇ ਵਿੱਚ ਘਰੇ ਰਹਿ ਕੇ ਕੰਮ ਕਰਦੀਆਂ ਵਾਂ ਅਤੇ ਨਾਲੇ ਖੁਦ ਖਾਂਦੀਆਂ ਨਾਲੇ ਪਰਿਵਾਰ ਨੂੰ ਖਵਾਉਂਦੀਆਂ ਵਾ ਅਤੇ ਇਹ ਜ਼ਰੂਰੀ ਨਹੀਂ ਕਿ ਮਰਦ ਖਾਣਾ ਨਹੀਂ ਬਣੋ ਬਣਾ ਸਕਦੇ ਜਾਂ ਨਹੀਂ ਬਣਵਾਉਂਦੇ ਪਰਿਵਾਰ ਦੇ ਨਾਲ ਉਹ ਪੂਰੀ ਮਤ ਕਰਵਾਉਂਦੇ ਸਾਡੇ ਮਰਦ ਘਰੇ ਖਾਣਾ ਬਣਾਉਣ ਦੀ